ਅਖ਼ਬਾਰ ਨੂੰ ਪਹਿਲਾਂ ਵਾਲੇ ਸਮੇਂ ਵਿੱਚ ਬਹੁਤ ਹੀ ਮਸ਼ਹੂਰ ਮੰਨਿਆ ਜਾਂਦਾ ਸੀ ਪਰ ਹੁਣ ਦਾ ਸਮਾਂ ਸੋਸਲ ਮੀਡੀਆ ਦਾ ਸਮਾਂ ਹੈ ਅੱਜ ਕੱਲ੍ਹ ਦੇ ਨੌਜਵਾਨ ਹਰ ਸਮੇਂ ਸੋਸਲ ਮੀਡੀਆ 'ਤੇ ਰਹਿੰਦੇ ਹਨ ਉਹ ਸੋਸਲ ਮੀਡੀਆ ਦਾ ਬਹੁਤ ਹੀ ਪ੍ਰਯੋਗ ਕਰਦੇ ਹਨ ਜਦੋਂ ਕਿ ਅਖ਼ਬਾਰਾਂ ਵਿੱਚ ਸਹੀ ਅਤੇ ਸਪੱਸ਼ਟ ਖ਼ਬਰਾਂ ਦਿੱਤੀਆਂ ਜਾਂਦੀਆਂ ਸਨ ਇਸ ਲਈ ਹੁਣ ਵੀ ਅਖ਼ਬਾਰਾਂ ਦੀ ਵਰਤੋਂ ਬਹੁਤ ਹੀ ਜਿਆਦਾ ਹੁੰਦੀ ਹੈ ਅਖਬਾਰਾਂ ਤੇ ਹੀ ਲੋਕ ਜ਼ਿਆਦਾ ਭਰੋਸਾ ਕਰਦੇ ਹਨ ਕਿਉਂਕਿ ਅੱਜ ਕੱਲ੍ਹ ਨਿਊਜ਼ ਚੈਨਲ ਆਪਣੇ ਮੁਨਾਫ਼ੇ ਲਈ ਖ਼ਬਰਾਂ ਨੂੰ ਵਧਾ ਚੜਾ ਕੇ ਪੇਸ਼ ਕਰਦੇ ਹਨ ਅਤੇ ਸੋਸਲ ਮੀਡੀਆ 'ਤੇ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ ਸੋਸਲ ਮੀਡੀਆ 'ਤੇ ਲੋਕਾਂ ਦੇ ਵਿਊ ਲੈਣ ਲਈ ਬਹੁਤ ਹੀ ਖ਼ਬਰਾਂ ਨੂੰ ਪੋਸਟ ਕੀਤਾ ਜਾਂਦੀਆਂ ਹਨ ਜਦੋਂ ਕਿ ਸਹੀ ਨਹੀਂ ਹੈ ਮੇਰਾ ਇਹ ਮੰਨਣਾ ਹੈ ਕਿ ਅੱਜ ਵੀ ਅਖ਼ਬਾਰਾਂ ਦਾ ਸਾਧਨ ਹੈ ਕਿਉਂਕਿ ਨਿਊਜ਼ ਚੈਨਲ 'ਤੇ ਬਹੁਤ ਹੀ ਘਟੀਆ ਅਤੇ ਗਲਤ ਖ਼ਬਰਾਂ ਦਿੰਦੇ ਹਨ ਜਦੋਂ ਕਿ ਅਖ਼ਬਾਰ ਵਿੱਚ ਬਹੁਤ ਸਾਰੀਆਂ ਸਹੀ ਅਤੇ ਸੂਚਨਾਵਾਂ ਖ਼ਬਰਾਂ ਦਿੰਦੇ ਹਨ ਸੋਸਲ ਮੀਡੀਆ ਦਾ ਪ੍ਰਯੋਗ ਬਹੁਤ ਸਾਰੇ ਮੀਡੀਆ ਦੇ ਪ੍ਰਦਰਸ਼ਨ ਕਰਨ ਲਈ ਕੀਤਾ ਜਾਂਦਾ ਹੈ ਅਤੇ ਜੋ ਕਿ ਬਹੁਤ ਹੀ ਪ੍ਰਸਿੱਧ ਹੈ ਅਖ਼ਬਾਰ ਦਾ ਬਹੁਤ ਹੀ ਮਹੱਤਵਪੂਰਨ ਹੈ ਆਪਣੇ ਆਪਣੇ ਭਾਸ਼ਾ ਦਾ ਇਹ ਅਖ਼ਬਾਰ ਬਹੁਤ ਹੀ ਸਾਰੇ ਭਾਸ਼ਾਵਾਂ ਵਿੱਚੋਂ ਹੁੰਦਾ ਹੈ ਅਖ਼ਬਾਰ ਅਖ਼ਬਾਰ ਸਭ ਤੋਂ ਵੱਧ ਜ਼ਰੂਰੀ ਹੈ ਕਿਉਂਕਿ ਸੋਸਲ ਮੀਡੀਆ 'ਤੇ ਬਹੁਤ ਹੀ ਗਲਤ ਖ਼ਬਰਾਂ ਛਾਪੀਆਂ ਜਾਂਦੀਆਂ ਹਨ ਲੋਕ ਆਪਣੇ ਵਿਊ ਲੈਣ ਲਈ ਹੋਰਾਂ ਦੀਆਂ ਨਿਊਜ਼ਾਂ ਪਾ ਦਿੰਦੇ ਹਨ ਇਸ ਕਰਕੇ ਅਖ਼ਬਾਰ ਨੂੰ ਅੱਜ ਦੇ ਤ ਸਮੇਂ ਵਿੱਚ ਬਹੁਤ ਵਧੀਆ ਸਾਧਨ ਮੰਨਿਆ ਜਾਂਦਾ ਹੈ ਜੋ ਕਿ ਬਹੁਤ ਹੀ ਵਧੀਆ ਹੈ ਇਸ ਕਰਕੇ ਅਸੀਂ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ 'ਤੇ ਭਰੋਸਾ ਕਰਨ ਨਾਲੋਂ ਅਖ਼ਬਾਰ ਉੱਤੇ ਭਰੋਸਾ ਕਰੀਏ